ਆਪ ਜੀ ਦੁਆਰਾ ਪੁੱਛੇ ਗਏ ਪ੍ਰਸ਼ਨ ਮੁਤਾਬਕ ਸੰਸਾਰ ਦੇ ਪੰਜ ਦੇਸ਼ਾਂ ਦਾ ਨਾਂ ਦੱਸਣੇ ਹਨ ਮੈਂ ਸਭ ਤੋਂ ਪਹਿਲਾਂ ਆਪਣੇ ਭਾਰਤ ਦੇਸ਼ ਦਾ ਨਾਂ ਦੱਸਣਾ ਚਾਹੁੰਦਾ ਹਾਂ ਅਤੇ ਦੂਸਰੇ ਨੰਬਰ 'ਤੇ ਭਾਰਤ ਦਾ ਗਵਾਂਢੀ ਮੁਲਕ ਦੇਸ਼ ਪਾਕਿਸਤਾਨ ਅਤੇ ਤੀਜੇ ਨੰਬਰ 'ਤੇ ਅਫਗਾਨਿਸਤਾਨ ਦਾ ਨਾਂ ਦੱਸਣਾ ਚਾਹੁੰਦਾ ਹਾਂ ਅਤੇ ਚੌਥੇ ਨੰਬਰ 'ਤੇ ਮੈਂ ਸੰਸਾਰ ਦੇ ਕਨੇਡਾ ਦੇਸ਼ ਦਾ ਨਾਂ ਦੱਸਣਾ ਚਾਹੁੰਦਾ ਹਾਂ ਅਤੇ ਸਭ ਤੋਂ ਅਖੀਰ 'ਤੇ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਅਮੈਰੀਕਾ ਦਾ ਨਾਂ ਲੈਣਾ ਚਾਹੁੰਦਾ ਹਾਂ